ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਕੀ ਹੈਲਪ ਮੈਮ ਅੱਛਾ ਜੀ ਹਾਂਜੀ ਜ਼ਰੂਰ ਮੈਮ ਪੁੱਛੋ ਵੈਸੇ ਤਾਂ ਮੈਮ ਪੰਜਾਬ ਇੱਕ ਬਹੁਤ ਹੀ ਕਲਚਰਲ ਸਟੇਟ ਵਾ ਮੀਨਜ਼ ਉੱਥੇ ਬਹੁਤ ਹੀ ਟਾਈਪ ਦੇ ਡਾਇਵਰ ਅ ਡਾਇਵਰਸਰਟੀ ਪਾਈ ਜਾਂਦੀ ਆ ਖਾਣੇ ਦੇ ਵਿੱਚ ਵੀ ਇੱਥੇ ਬਹੁਤ ਸਾਰੇ ਫੇਮਸ ਫੂਡਸ ਨੇ ਲਾਈਕ ਜਿਵੇਂ ਹੁਣ ਮੈਂ ਸਰਦੀਆਂ ਦੀ ਸਰਦੀ ਦਾ ਮੌਸਮ ਹੈ ਅਤੇ ਸਰਦੀ ਦੇ ਮੌਸਮ ਦੇ ਵਿੱਚ ਲੋਕਾਂ ਨੂੰ ਸਾਗ ਅਤੇ ਮੱਕੀ ਦੀ ਰੋਟੀ ਖਾਣੀ ਬਹੁਤ ਪਸੰਦ ਆ ਅਤੇ ਮੀਨਸ ਜਿਹੜੇ ਮਾਲਵੇ ਦੇ ਲੋਕ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਚਾਅ ਅਤੇ ਲਾਡ ਨਾਲ ਖਾਂਦੇ ਨੇ ਮਤਲਬ ਕਿ ਜਿੰਨੇ ਵੀ ਟੂਰਿਸਟ ਈਵਨ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਉਹ ਸਪੈਸ਼ਲੀ ਆ ਕੇ ਸਭ ਤੋਂ ਪਹਿਲਾਂ ਤਾਂ ਇਹ ਸਾਗ ਅਤੇ ਮੱਕੀ ਦੀ ਰੋਟੀ ਟ੍ਰਾਈ ਕਰਦੇ ਹੈ ਭਾਵੇਂ ਢਾਬੇ ਤੋਂ ਕਰਨੀ ਪਵੇ ਭਾਵੇਂ ਕਿਤੋਂ ਵੀ ਕਰਨੀ ਪਵੇ ਹਾਂਜੀ ਹਾਂਜੀ ਅਤੇ ਮਤਲਬ ਕਿ ਇੱਦਾਂ ਹੈ ਵੀ ਮੀਨਸ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕ ਸਰਦੀਆਂ ਦੇ ਵਿੱਚ ਕਮ ਸੇ ਹਫਤੇ ਬਾਅਦ ਹੀ ਬਣਾਉਣ ਲੱਗ ਜਾਂਦੇ ਨੇ ਤੁਸੀਂ ਕਿਉਂਕਿ ਹੋਰ ਬਹੁਤ ਫੂਡ ਆ ਫੇਮਸ ਆ ਜਿਵੇਂ ਕਿ ਅੰਬਰਸਰ ਜਿਹੜਾ ਸ਼ ਅ ਜਿਲ੍ਹਾ ਹੈ ਆ ਉੱਥੋਂ ਦੇ ਅੰਬਰਸਰ ਦੇ ਕੁਲਚੇ ਹੋ ਗਏ ਬੜੀਆਂ ਹੋ ਗਈਆਂ ਪਾਪੜ ਹੋ ਗਏ ਬਹੁਤ ਲੋਕ ਚਾਅ ਨਾਲ ਖਾਂਦੇ ਨੇ ਅਤੇ ਜਿੰਨੇ ਵੀ ਪੰਜਾਬੀ ਜਾਂ ਬਾਹਰਲੇ ਫੋਰਨਰ ਆਉਂਦੇ ਨੇ ਕਿਤੇ ਜਾ ਆਉਂਦੇ ਅੰਬਰਸਰ ਸਾਹਿਬ ਇੱਕ ਇਤਿਹਾਸਿਕ ਸ਼ਹਿਰ ਵੀ ਆ ਤਾਂ ਉੱਥੇ ਆ ਕੇ ਵੀ ਆਪਣਾ ਮਤਲਬ ਕਿ ਫੂਡ ਨੂੰ ਬਹੁਤ ਇੰਜੋਏ ਕਰਦੇ ਨੇ ਬਹੁਤ ਡਿਫਰੈਂਟ ਟਾਈਪ ਆਫ ਫੂਡਜ ਨੇ ਇੰਡੀਆ ਦੇ ਵਿੱਚ ਜਿਹੜੇ ਪਾਏ ਜਾਂਦੇ ਨੇ ਜਿਵੇਂ ਡਰਿੰਕਸ ਦੀ ਗੱਲ ਕਰਾਂ ਤਾਂ ਲੱਸੀ ਹੋ ਗਈ ਗੰਨੇ ਦਾ ਜੂਸ ਹੋ ਗਿਆ ਇਹ ਵੀ ਬਹੁਤ ਫੇਮਸ ਆ ਜਿਵੇਂ ਮਤਲਬ ਕਿ ਹੁਣ ਤੁਸੀਂ ਜੇ ਬਲੋਗਿੰਗ ਕਰਦੇ ਹੋ ਤਾਂ ਗੰਨੇ ਦੇ ਜੂਸ ਦੇ ਜਦੋਂ ਉਹਨਾਂ ਨੂੰ ਕੱਢਦੇ ਹਾਂ ਤਾਂ ਤੁਸੀਂ ਚੱਲਦੀ ਘਲਾੜੀ ਵੀ ਦੇਖ ਸਕਦੇ ਹੋ ਜਿਹਦੇ ਵਿੱਚ ਗੰਨੇ ਦੇ ਜੂਸ ਤੋਂ ਗੁੜ ਵੀ ਬਣਾਇਆ ਜਾਂਦਾ ਹਾਂ ਅਤੇ ਲੋਕ ਮਤਲਬ ਕਿ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਮਤਲਬ ਕਿ ਤੁਸੀਂ ਉਹ ਘਲਾੜੀ ਵੀ ਦੇਖ ਸਕਦੇ ਹੋ ਚੱਲਦੀ ਵੀ ਜਿਹਦੇ ਵਿੱਚ ਉਹ ਗੰਨੇ ਦੇ ਜੂਸ ਦੇ ਥਰੂ ਮਤਲਬ ਕਿ ਉਹ ਗੁੜ ਬਣਾਉਂਦੇ ਹਾਂ ਲਾਈਵ ਅਤੇ ਉਹ ਗੁੜ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਕਿਉਂਕਿ ਉਹ ਗੁੜ ਦੇ ਵਿੱਚ ਨਾ ਤਾਂ ਕੋਈ ਮਿਲਾਵਟ ਹੁੰਦੀ ਆ ਐਨ ਪਿਓਰ ਫੋਮ ਓਫ ਗੁੜ ਹੁੰਦੀ ਆ ਉਸ ਤੋਂ ਸਿਵਾ ਵੀ ਹੋਰ ਬਹੁਤ ਜ਼ਿਆਦਾ ਫੂਡ ਬਹੁਤ ਹੀ ਜ਼ਿਆਦਾ ਫੂਡ ਫੇਮਸ ਨੇ ਲਾਈਕ ਲੋਕਾਂ ਨੂੰ ਚਾਹ ਪਕੌੜੇ ਖਾਣੇ ਵੀ ਬਹੁਤ ਪਸੰਦ ਨੇ ਸਵੀਟਸ ਖਾਣੀਆਂ ਵੀ ਬਹੁਤ ਪਸੰਦ ਨੇ ਗਰਮੀ 'ਚ ਵਿੱਚ ਗਰਮੀ ਦੇ ਵਿੱਚ ਬਸ ਇਹੀ ਠੰਡਾ ਮਿਲੀ ਜਾਵੇ ਕੁਝ ਨਾ ਕੁਝ ਖਾਣ ਨੂੰ ਉਹ ਸਾਰਾ ਕੁਝ ਖਾਈ ਜਾਂਦੇ ਹਾਂ ਹਾਂਜੀ ਅਤੇ ਮੀਨਸ ਬਹੁਤ ਟਾਈਪ ਓਫ ਫੂਡਸ ਨੇ ਜਿਵੇਂ ਗਰਮੀ ਦੇ ਵਿੱਚ ਗੱਲ ਕਰੀਏ ਤਾਂ ਲੋਕਾਂ ਨੂੰ ਜਿਵੇਂ ਹੋ ਗਿਆ ਠੰਡਾ ਜੂਸ ਹੋ ਗਿਆ ਲੱਸੀ ਹੋ ਗਈ ਲੱਸੀ ਪੀ ਬਣਾ ਬਣਾ ਪੀ ਜਾਂਦੇ ਨੇ ਮੱਖਣ ਹੋ ਗਿਆ ਇੱਦਾਂ ਦਾ ਖਾਣਾ ਜਿਹੜਾ ਬਹੁਤ ਪਸੰਦ ਆ ਪਰੋਂਠੇ ਵੀ ਖਾਂਦੇ ਰਹਿੰਦੇ ਨੇ ਹਾਂਜੀ ਆਈਸਕ੍ਰੀਮਸ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਅਤੇ ਬਹੁਤ ਟਾਈਪ ਓਫ ਫੂਡ ਵਰੈਟੀਜ਼ ਨੇ ਜਿਹੜੀਆਂ ਤੁਸੀਂ ਬਲੋਗ 'ਤੇ ਬਣਾ ਸਕਦੇ ਹੋ ਜਦੋਂ ਵੀ ਤੁਸੀਂ ਕਦੇ ਪੰਜਾਬ ਵਿਜਿਟ ਕਰਨਾ ਹੋਵੇ ਤੁਸੀਂ ਮੈਨੂੰ ਕੋਲ ਕਰਿਓ ਅਤੇ ਮੈਂ ਤੁਹਾਨੂੰ ਆਪੇ ਸਾਰਾ ਕੁਝ ਦੱਸ ਦਉਂਗੀ ਕਿੱਥੋਂ ਕਿੱਥੋਂ ਕਿਹੜੀ ਕਿਹੜੀ ਚੀਜ਼ ਫੇਮਸ ਆ ਜਿਵੇਂ ਆਪਣੇ ਮਾਝੇ ਦੇ ਏਰੀਏ ਦੇ ਵਿੱਚ ਵੀ ਬਹੁਤ ਖਾਣਾ ਫੇਮਸ ਆ ਬਟ ਜਿਹੜਾ ਮਾਲਵੇ ਦਾ ਖਾਣਾ ਹੈ ਆ ਉਹ ਹੋਰ ਹੀ ਲੈਵਲ ਦਾ ਆ ਬਹੁਤ ਜ਼ਿਆਦਾ ਫੇਮਸ ਆ ਠੀਕ ਔਲਵੇਜ ਵੈਲਕਮ ਜੀ ਠੀਕ